ਕਲਾ ਸਾਡੀ ਜ਼ਿੰਦਗੀ ਵਿੱਚ ਮਹੱਤਵਪੂਰਨ ਅਹਿਮੀਅਤ ਰੱਖਦੀ ਹੈ ਹੁਣ ਕਲਾ ਸਿਰਫ ਸਾਨੂੰ ਸਾਡੇ ਨਵੇਂ ਨਵੇਂ ਕੰਮਾਂ ਨ ਨੂੰ ਨਾਲ ਹੀ ਨਹੀਂ ਜੋੜਦੀ ਕਲਾ ਸਾਡੇ ਮਨ ਨੂੰ ਵੀ ਸ਼ਾਂਤ ਕਰਦੀ ਹੈ ਕਈ ਲੋਕ ਕਲਾ ਨੂੰ ਆਪਣੇ ਦਿਮਾਗ ਨੂੰ ਸ਼ਾਂਤ ਕਰਨ ਦਾ ਟੀਚਾ ਸਮਝ ਲੈਂਦੇ ਹਨ ਅਤੇ ਅੱਜ ਕੱਲ੍ਹ ਲੋਕ ਕਲਾ ਦੇ ਰਾਹੀਂ ਬਹੁਤ ਪ੍ਰਸਿੱਧ ਹੁੰਦੇ ਜਾ ਰਹੇ ਹਨ ਜਿਵੇਂ ਕਿ ਕਈ ਕਈ ਕਈ ਅਲੱਗ ਅਲੱਗ ਤਰ੍ਹਾਂ ਦੀਆਂ ਸੰਸਥਾਵਾਂ ਅਤੇ ਪ੍ਰੋਗਰਾਮ ਹਨ ਜਿਵੇਂ ਵਾਈਸ ਓਫ ਪੰਜਾਬ ਅਤੇ ਹੋਰ ਕਈ ਜਿਨ੍ਹਾਂ ਦੇ ਕਾਰਨ ਲੋਕ ਆਪਣੇ ਆਪ ਨੂੰ ਲੋਕਾਂ ਅੱਗੇ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰ ਪਾ ਰਹੇ ਹਨ